ਫੋਟੋਗ੍ਰਾਫੀ ਸਕਿੱਲ ਦੇ ਨਾਲ ਨਾਲ ਇੱਕ ਆਰਟ ਵੀ ਹੈ ਕੋਈ ਵੀ ਕੰਮ ਜਦੋਂ ਅਸੀਂ ਮਨੋਂ ਆਪਣੀ ਲਗਨ ਦੇ ਨਾਲ ਸ਼ੌਕ ਵਜੋਂ ਕਰਦੇ ਹਾਂ ਤਾਂ ਉਸ ਦੇ ਵਿੱਚ ਨਿਖਾਰ ਹੁੰਦਾ ਜਾਂਦਾ ਹੈ ਸੇਮ ਹੀ ਫੋਟੋਗ੍ਰਾਫੀ ਹੈ ਜਦੋਂ ਅਸੀਂ ਕੈਮਰੇ ਦੇ ਨਾਲ ਵਾਰ ਵਾਰ ਫੋਟੋ ਖਿੱਚਣ ਦੀ ਪ੍ਰੈਕਟਿਸ ਕਰਦੇ ਹਾਂ ਤਾਂ ਸਾਨੂੰ ਉਹਦੀ ਨੌਲੇਜ ਦੇ ਵਿੱਚ ਵਾਧਾ ਹੁੰਦਾ ਹੈ ਅਤੇ ਸਾਡੀ ਫੋਟੋ ਖਿੱਚਣ ਦੀ ਸ਼ਕਤੀ ਵਿੱਚ ਵੀ ਨਿਖਾਰ ਹੁੰਦਾ ਹੈ ਸਪੋਜ ਕਰੋ ਇੱਕ ਹੀ ਕੈਮਰਾ ਔਰ ਇੱਕ ਹੀ ਪਰਸਨ ਦੀ ਫੋਟੋ ਖਿੱਚਣ ਲਈ ਅਸੀਂ ਦਸ ਬੰਦਿਆਂ ਨੂੰ ਅਲੱਗ ਅਲੱਗ ਚਾਂਸ ਦਿੰਦੇ ਹਾਂ ਹਰ ਇੱਕ ਬੰਦੇ ਦਾ ਫੋਟੋ ਖਿੱਚਣ ਦਾ ਤਰੀਕਾ ਅਤੇ ਉਸਦਾ ਰਿਜ਼ਲਟ ਅਲੱਗ ਅਲੱਗ ਹੋਏਗਾ ਜਿਹੜਾ ਬੰਦਾ ਆਪਣੇ ਦਿਲੋਂ ਕੰਮ ਕਰੇਗਾ ਉਸਦੀ ਇਮੇਜ਼ ਜ਼ਿਆਦਾ ਵਧੀਆ ਆਏਗੀ ਅੱਜ ਕੱਲ੍ਹ ਅਸੀਂ ਫੋਟੋਗ੍ਰਾਫੀ ਨੂੰ ਆਪਣੇ ਪ੍ਰੋਫੈਸ਼ਨ ਵਜੋਂ ਵੀ ਚੁਣ ਸਕਦੇ ਹਾਂ ਜਿਸ ਤਰ੍ਹਾਂ ਕਿ ਵੈਡਿੰਗ ਫੋਟੋਗ੍ਰਾਫੀ ਵਾਇਲਡਲਾਈਫ ਫੋਟੋਗ੍ਰਾਫੀ ਮੀਡੀਆ ਫੋਟੋਗ੍ਰਾਫੀ ਐਡਵਰਟਾਈਜਮੈਂਟ ਲਈ ਫੋਟੋਗ੍ਰਾਫੀ ਅਸੀਂ ਆਪਣੀ ਫੋਟੋ ਖਿੱਚ ਕੇ ਇੰਸਟਾਗ੍ਰਾਮ ਫੇਸਬੁੱਕ ਆਦਿ ਉੱਤੇ ਪਾ ਕੇ ਲੋਕਾਂ ਨੂੰ ਆਪਣੇ ਆਰਟ ਪ੍ਰਤੀ ਖਿੱਚ ਸਕਦੇ ਹਾਂ ਅਸੀਂ ਉਹਨਾਂ ਨੂੰ ਦਿਖਾ ਸਕਦੇ ਹਾਂ ਕਿ ਇਹ ਸਾਡਾ ਪ੍ਰੋਫੈਸ਼ਨ ਉਹਨਾਂ ਦੀ ਵਰਤੋਂ ਦੇ ਵਿੱਚ ਆ ਸਕਦਾ ਹੈ ਲੋਕ ਆਪਣੀ ਵੈਡਿੰਗਸ ਵਗੈਰਾ ਲਈ ਆਪਣੀ ਪ੍ਰਮੋਸ਼ਨਸ ਦੇ ਲਈ ਸਾਨੂੰ ਹਾਇਰ ਕਰ ਸਕਦੇ ਹਨ ਜਿਸ ਤੋਂ ਅਸੀਂ ਅੱਛੀ ਖਾਸੀ ਇਨਕਮ ਪੈਦਾ ਕਰ ਸਕਦੇ ਹਾਂ